ਹਾਂਜੀ ਸਾਡੇ ਇਲਾਕੇ ਦੇ ਬੱਚੇ ਰਾਸ਼ਟਰੀ ਮੁਕਾਬਲੇ ਦੀ ਪ੍ਰੀਖਿਆਵਾਂ ਦਿੰਦੇ ਹਨ ਉਹ ਇਹ ਪ੍ਰੀਖਿਆਵਾਂ ਯੂਟੀਊਬ ਤੋਂ ਵ ਵੀਡੀਓ ਦੇਖ ਕੇ ਕਿਤਾਬਾਂ ਪੜ੍ਹ ਕੇ ਜਾਂ ਜਿਨ੍ਹਾਂ ਨੇ ਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੁੰਦਾ ਹੈ ਉਹਨਾਂ ਦੇ ਤਜ਼ਰਬੇ ਸੁਣ ਕੇ ਕਰਦੇ ਹਨ ਕੋਈ ਵੀ ਸੰਸਥਾ ਆਰਜ਼ੀ ਅਤੇ ਪ੍ਰੀਖਿਆ ਪ੍ਰਕਿਰਿਆ ਵਿੱਚ ਉਹਨਾਂ ਦੀ ਮਦਦ ਨਹੀਂ ਕਰਦੀ ਉਹਨਾਂ ਨੂੰ ਇਹ ਪ੍ਰੀਖਿਆਵਾਂ ਆਪਣੇ ਬਲਬੂਤੇ ਉੱਤੇ ਹੀ ਦੇਣੀਆਂ ਪੈਂਦੀਆਂ ਹਨ ਜਿਵੇਂ ਕਿ ਕੋਈ ਖਰਚਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹੂਲਤ ਹੈ ਕੋਈ ਵੀ ਸੰਸਥਾ ਨਹੀਂ ਕਰਦੀ